ਮੈਨੂੰ ਡਾਂਸ ਦੀਆਂ ਸਭ ਤੋਂ ਵੱਧ ਪਸੰਦ ਸ਼ੈਲੀਆਂ ਹਨ ਬ੍ਰੇਕ ਡਾਂਸ ਅਤੇ ਹਿਪ ਹੋਪ ਡਾਂਸ ਅਤੇ ਕੱਥਕ ਅਤੇ ਭੰਗੜਾ ਕਿਉਂਕਿ ਜਿਹੜੇ ਇਹ ਡਾਂਸ ਨੇ ਜਿਹੜਾ ਮੈਂ ਬ੍ਰੇਕ ਡਾਂਸ ਆ ਇਹਦੀਆਂ ਮੈਂ ਵੱਖਰੀਆਂ ਕਲਾਸਾਂ ਲਾਈਆਂ ਸੀ ਇਸ ਦੇ ਵਿੱਚ ਸਿਰਫ਼ ਆਪਣੇ ਅੰਗਾਂ ਦੀ ਜਿਹੜੀ ਆ ਉਹ ਹਿਲਜੁਲ ਹੁੰਦੀ ਆ ਆਪਾਂ ਆਪਣੇ ਸਰੀਰ ਨੂੰ ਨਹੀਂ ਹਿਲਾਉਣਾ ਇਸ ਨਾਲ ਬਹੁਤ ਵਧੀਆ ਪ੍ਰਭਾਵ ਪੈਂਦਾ ਵਾ ਵੇਖਣ ਵਾਲਿਆਂ 'ਤੇ ਅਤੇ ਇਸ ਦੀ ਬਹੁਤ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਇਸਨੂੰ ਬਹੁਤ ਵੱਡੇ ਪੱਧਰ 'ਤੇ ਵੇਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਮੈਨੂੰ ਭੰਗੜਾ ਬਹੁਤ ਪਸੰਦ ਹੈ ਜਿਵੇਂ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਪੰਜਾਬ ਵਿੱਚ ਰਹਿਣ ਦੇ ਨਾਲ ਨਾਲ ਅਸੀਂ ਪੰਜਾਬੀ ਹੋਣ ਦੇ ਨਾਲ ਆਪਣੇ ਸਭਿਆਚਾਰ ਨੂੰ ਨਹੀਂ ਭੁਲਾਉਣਾ ਚਾਹੁੰਦੇ ਇਸ ਕਰਕੇ ਜਿਹੜਾ ਭੰਗੜਾ ਹੈ ਉਹ ਤਾਂ ਮੈਨੂੰ ਇੰਨਾ ਕੁ ਜ਼ਿਆਦਾ ਪਸੰਦ ਹੈ ਕਿ ਮੈਂ ਆਪਣੇ ਸਕੂਲ ਦੇ ਹਰ ਫੰਕਸ਼ਨ ਦੇ ਵਿੱਚ ਕਰਦੀ ਹਾਂ ਅਤੇ ਉਸ ਤੋਂ ਬਾਅਦ ਕੱਥਕ ਵੀ ਮੈਨੂੰ ਬਹੁਤ ਪਸੰਦ ਹੈ ਕੱਥਕ ਜਿਵੇਂ ਕਿ ਹਰਿਆਣਵੀ ਡਾਂਸ ਹੈ ਅਤੇ ਕੱਥਕ ਦੇ ਵਿੱਚ ਵੀ ਮੈਂ ਬਹੁਤ ਟੈਲੈਂਟੇਡ ਹਾਂ